ਹੈਲੋ ਮੈਂ ਅਰੁਨਾ ਬੋਲ ਰਹੀ ਹਾਂ ਗੁਰਦਾਸਪੁਰ ਤੋਂ ਮੈਂ ਨਾ ਤੁਹਾਡੀ ਅ ਕੈਬ ਬੁੱਕ ਕਰਵਾਈ ਸੀ ਵੀ ਮੈਨੂੰ ਸਵੇਰੇ ਛੇ ਵਜੇ ਬੱਸ ਸਟੈਂਡ ਤੋਂ ਵੀ ਜਲੰਧਰ ਮੈਂ ਜਾਣਾ ਮੈਨੂੰ ਉੱਥੇ ਲੈ ਜਾਇਓ ਜਲੰਧਰ ਲੈ ਜਾਇਓ ਅਤੇ ਹੁਣ ਮੇਰਾ ਨਾ ਉਹ ਪ੍ਰੋਗਰਾਮ ਬਦਲ ਹੋ ਗਿਆ ਅਤੇ ਮੈਂ ਹੁਣ ਨਾ ਸਟੇਸ਼ਨ 'ਤੇ ਆ ਗਈ ਹਾਂ ਸਟੇਸ਼ਨ ਹੈ ਮੇਰੇ ਲਾਗੇ ਪੈਦਲ ਆਈ ਹਾਂ ਅਤੇ ਸਮਾਨ ਹੈ ਬੱਚੇ ਹੈ ਨਾਲ ਅਤੇ ਮੈਂ ਤੁਹਾਡੀ ਵੇਟ ਕਰਨ ਡਈ ਹਾਂ ਫੋਨ ਕਰਦੀ ਪਈ ਤੁਸੀਂ ਫੋਨ ਨਹੀਂ ਚੁੱਕਣ ਡੇ ਅਤੇ ਤੁਸੀਂ ਨਾ ਕਿੰਨਾ ਨਹੀਂ ਮੇਰੇ ਰਿਸ਼ਤੇਦਾਰ ਫੋਨ ਕਰਨ ਡੇ ਹੈ ਜਲੰਧਰ ਪਹੁੰਚਣਾ ਉੱਥੇ ਫ਼ੰਕਸ਼ਨ ਹੈ ਅਤੇ ਉਹ ਗੁੱਸੇ ਹੁੰਦੇ ਪਏ ਅਤੇ ਘਰਦੇ ਮੇਰੇ ਵੀ ਗੁੱਸੇ ਹੋਣ ਡੇ ਹੈ ਅਤੇ ਤੁਸੀਂ ਪਹੁੰਚਣ ਨਹੀਂ ਡਏ ਅਤੇ ਤੁਸੀਂ ਜਲਦੀ ਭੇਜੋ ਅਤੇ ਫੋਨ ਤੁਹਾਡਾ ਡਰੈਵਰ ਚੁੱਕਦਾ ਨਹੀਂ ਪਿਆ ਅਤੇ ਉਹ ਮੈਂ ਪ੍ਰੇਸ਼ਾਨ ਹਾਂ ਮੈਨੂੰ ਬਹੁਤ ਮੁਸ਼ਕਲ ਆ ਮੈਂ ਬੱਚਿਆਂ ਨਾਲ ਸਟੇਸ਼ਨ 'ਤੇ ਖਲੋਤੀ ਤੁਹਾਡੀ ਉਡੀਕ ਲਾਈ ਦੀ ਹੈ ਅਤੇ ਇਸ ਕਰਕੇ ਮੈਂ ਕਦੋਂ ਦੀ ਫੋਨ ਕਰਦੀ ਪਈ ਵੀ ਤੁਹਾਡਾ ਡਰੈਵਰ ਬੱਸ ਸਟੈਂਡ 'ਤੇ ਨਾ ਜਾਏ ਅਤੇ ਮੈਂ ਇੱਥੇ ਆ ਕੇ ਬ ਸਟੇਸ਼ਨ 'ਤੇ ਅਤੇ ਮੈਨੂੰ ਲੈ ਜਾਵੇ ਅਤੇ ਜਲਦੀ ਭੇਜੋ